ਹੈਲੋ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਢਿੱਲੋਂ ਕੈਬਸ ਤੋਂ ਬੋਲ ਰਹੇ ਹੋ ਹਾਂਜੀ ਭਾਜੀ ਅੱਜ ਰਾਤ ਨੂੰ ਬਾਰ੍ਹਾਂ ਵਜੇ ਮੇਰੀ ਫਲੈਟ ਹੈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡਾ ਆਟੋ ਜਾਂ ਕੋਈ ਕੈਬ ਉਪਲਬਧ ਹੈ ਹਾਂਜੀ ਮੇਰਾ ਐਡਰੈੱਸ ਹੈਗਾ ਜੀ ਪਰਲੀ ਪਡਿਆਲਾ ਗਲੀ ਨੰਬਰ ਤਿੰਨ ਕੋਠੀ ਨੰਬਰ ਹੈਗਾ ਏ ਤਿੰਨ ਹਾਂਜੀ ਅਤੇ ਤੁਸੀਂ ਮੈਨੂੰ ਆਪਣਾ ਰੇਟ ਵੀ ਦੱਸ ਸਕਦੇ ਹੋ ਕਿੰਨੇ ਰੁਪਏ ਕਿੱਲੋਮੀਟਰ ਦੇ ਹਿਸਾਬ ਨਾਲ ਤੁਸੀਂ ਪੈਸੇ ਚਾਰਜਸ ਲਵੋਂਗੇ ਠੀਕ ਹੈ ਜੀ ਹਾਂਜੀ ਓਕੇ ਜੀ ਥੈਂਕ ਯੂ ਜੀ